ਆਪਣੇ ਬਾਈਕਿੰਗ ਦੇ ਸ਼ੌਂਕ ਅਤੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਸੰਤੁਲਨ ਵਿੱਚ ਰੱਖਣ ਲਈ ਮੈਨੂੰ ਬਹੁਤ ਸਾਰੀ ਚੀਜ਼ਾਂ ਦਾ ਧਿਆਨ ਰੱਖਨਾ ਪੈਂਦਾ ਹੈ ਅਤੇ ਬਹੁਤ ਸਾਰੇ ਤੌਰ ਤਰੀਕੇ ਵਰਤਨੇ ਪੈਂਦੇ ਹਨ ਕੁਝ ਤੌਰ ਤਰੀਕੇ ਹਨ ਜਿਵੇਂ ਕਿ ਮੈਂ ਆਪਣੀ ਬਾਈਕ ਰਾਈਡ ਦਾ ਸਮਾਂ ਆਪਣੇ ਪਰਿਵਾਰਕ ਕੰਮਕਾਰ ਮੁਕਾਉਣ ਤੋਂ ਬਾਅਦ ਹੀ ਰੱਖਦਾ ਹਾਂ ਕਈ ਵਾਰ ਜੇ ਮੇਰੇ ਕੋਲ ਸਮਾਂ ਘੱਟ ਹੋਵੇ ਤਾਂ ਮੈਂ ਛੋਟੀ ਛੋਟੀ ਰਾਈਡ 'ਤੇ ਚਲਾ ਜਾਂਦਾ ਹਾਂ ਤਾਂ ਕਿ ਮੇਰਾ ਸ਼ੌਂਕ ਪੂਰਾ ਹੋ ਸਕੇ ਕਈ ਵਾਰ ਮੈਂ ਸਵੇਰੇ ਘਰ ਵਾਲਿਆਂ ਦੇ ਉੱਠਣ ਤੋਂ ਪਹਿਲਾਂ ਹੀ ਰਾਈਡ 'ਤੇ ਚਲਾ ਜਾਂਦਾ ਹਾਂ ਅਤੇ ਉਹਨਾਂ ਦੇ ਉੱਠਣ ਤੋਂ ਪਹਿਲਾਂ ਹੀ ਵਾਪਿਸ ਆ ਜਾਂਦਾ ਹਾਂ ਤਾਂ ਕਿ ਮੈਂ ਉਹਨਾਂ ਨਾਲ ਕੰਮ ਵੀ ਕਰਵਾ ਸਕਾਂ ਅਤੇ ਆਪਨਾ ਬਾਈਕਿੰਗ ਦਾ ਸ਼ੌਂਕ ਵੀ ਪੂਰਾ ਕਰ ਸਕਾਂ ਸੋ ਮੈਨੂੰ ਆਪਨੇ ਪਰਿਵਾਰਿਕ ਜ਼ਿੰਮੇਵਾਰੀਆਂ ਅਤੇ ਬਾਈਕਿੰਗ ਦੇ ਸ਼ੌਂਕ ਨੂੰ ਪੂਰਾ ਕਰਨ ਲਈ ਬਹੁਤ ਸਾਰੀ ਤੌਰ ਤਰੀਕੇ ਵਰਤਨੇ ਪੈਂਦੇ ਹਨ ਤਾਂ ਕਿ ਮੈਂ ਆਪਣਾ ਸ਼ੌਂਕ ਵੀ ਪੂਰਾ ਕਰ ਲਵਾਂ ਅਤੇ ਮੇਰੇ ਪਰਿਵਾਰ ਨੂੰ ਕੋਈ ਜੋਖਿਮ ਵੀ ਨਾ ਆਵੇ